ਅਸੀਂ ਬਚਪਨ ਵਿੱਚ ਸਕੂਲ ਤੋਂ ਹੀ ਬਹੁਤ ਪੇਂਟਿੰਗ ਸਿੱਖੀ ਸਾਡੇ ਸਕੂਲ ਵਿੱਚ ਇੱਕ ਡਰਾਇੰਗ ਦੀ ਅਧਿਆਪਕ ਹੁੰਦੀ ਸੀ ਉਹਨਾਂ ਸਾਨੂੰ ਸਭ ਤੋਂ ਪਹਿਲਾਂ ਲਕੀਰਾਂ ਨੂੰ ਕਈ ਢੰਗ ਨਾਲ ਲਗਾਉਣ ਦਾ ਤਰੀਕਾ ਦੱਸਿਆ ਫਿਰ ਉਹਨਾਂ ਨੇ ਸਾਨੂੰ ਕਿਸੇ ਦੀ ਚਿੱਤਰ ਬਣਾਉਣ ਦਾ ਤਰੀਕਾ ਦੱਸਿਆ ਬਹੁਤ ਸਾਰੇ ਬੋਕਸ ਬਣਾ ਕੇ ਉਸ ਵਿੱਚ ਬਹੁਤ ਸਾਰੇ ਕਿਸੇ ਦਾ ਵੀ ਚਿੱਤਰ ਜਿਵੇਂ ਅੱਖਾਂ ਨੱਕ ਕੰਨ ਆਦਿ ਬਣਾਇਆ ਜਾਂਦਾ ਹੈ ਫਿਰ ਇਸ ਵਿੱਚ ਰੰਗ ਭਰਨ ਦਾ ਤਰੀਕਾ ਦੱਸਿਆ ਜਾਂਦਾ ਹੈ ਰੰਗਾਂ ਦੀ ਪਹਿਚਾਣ ਸਿਖਾਈ ਜਾਂਦੀ ਹੈ ਅਤੇ ਰੰਗਾਂ ਨੂੰ ਮਿਲਾ ਕੇ ਕਿਵੇਂ ਹੋਰ ਰੰਗ ਤਿਆਰ ਕੀਤੇ ਜਾਂਦੇ ਹਨ ਅਧਿਆਪਕ ਨੇ ਸਾਨੂੰ ਫੁੱਲਾਂ ਦੀ ਆਕਾਰ ਦਾ ਤਰੀਕਾ ਵੀ ਦੱਸਿਆ ਇਸ ਪ੍ਰਕਾਰ ਮੈਂ ਆਪਣੀ ਇਸ ਚਿੱਤਰਕਲਾ ਦਾ ਆਰੰਭ ਕੀਤਾ ਇਹ ਤਜਰਬਾ ਮੇਰੀ ਸਾਰੀ ਉਮਰ ਯਾਦ ਰੱਖਣ ਵਾਲਾ ਹੈ ਹੁਣ ਮੈਂ ਇਸ ਕਲਾ ਨੂੰ ਆਪਣਾ ਰੁਜ਼ਗਾਰ ਬਣਾ ਲਿਆ ਹੈ ਮੈਨੂੰ ਚਿੱਤਰ ਕਲਾ ਬਣਾਉਣੀ ਬਹੁਤ ਪਸੰਦ ਹੈ